ਹੈਲੋ ਸਤਿ ਸ਼੍ਰੀ ਅਕਾਲ ਭਾਅ ਜੀ ਭਾਅ ਜੀ ਹੋਰ ਸੁਣਾਓ ਕਿੱਦਾਂ ਵਧੀਆ ਸਭ ਭਾਜੀ ਮੈਂ ਵਿਨਾਸ਼ਕ ਸਿੰਘ ਬੋਲਿਆ ਜਾਨਾ ਮੈਂ ਐਕਚੁਲੀ ਇੱਧਰ ਬਾ ਬਾਹਰੋਂ ਆਇਆ ਅਤੇ ਪੰਜਾਬ ਦੇਖਣ ਆਇਆ ਸੀ ਅਤੇ ਮੈਨੂੰ ਕਿਸੇ ਮੇਰੇ ਵਾਕਫ਼ ਨੇ ਤੁਹਾਡਾ ਨੰਬਰ ਦਿੱਤਾ ਅਤੇ ਉਹਨਾਂ ਨੇ ਦੱਸਿਆ ਕਿ ਭਾਅ ਜੀ ਤੁਹਾਨੂੰ ਸ਼ਹਿਰ ਵਗੈਰਾ ਸਭ ਕੁਛ ਘੁੰਮਾਉਣਗੇ ਅਤੇ ਭਾਅ ਜੀ ਮੈਂ ਇੱਧਰੋਂ ਸਾਊਥ ਵੱਲੋਂ ਆਇਆ ਅਤੇ ਮੈਂ ਇੱਧਰ ਗੁਰਦਾਸਪੁਰ 'ਚ ਅੱਜ ਘੁੰਮਣਾ ਫਿਰਨਾ ਸੀ ਅਤੇ ਉਹਦੇ ਬਾਰੇ ਕੁਛ ਖਾਣ ਪੀਣ ਬਾਰੇ ਜਿੱਦਾਂ ਪਲੇਸਿਸ ਘੁੰਮਣ ਫਿਰਨ ਵਾਲੀ ਜਗ੍ਹਾਵਾਂ ਉਹ ਦੇਖਣੀਆ ਸੀ ਅਤੇ ਇੱਧਰ ਕੋਈ ਇੱਧਰ ਕੋਈ ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਹਾਂਜੀ ਚਲੋ ਠੀਕ ਆ ਭਾਅ ਜੀ ਤੁਸੀਂ ਮੇਰਾ ਨੰਬਰ ਲਿਖ ਲਿਓ ਇਹੀ ਹੈ ਅਤੇ ਤੁਸੀਂ ਮੈਨੂੰ ਫੋਨ ਕਰ ਲਿਓ ਮੈਂ ਤੁਹਾਨੂੰ ਫੋਨ ਕਰ ਦਾਂਗਾ ਜਿਵੇਂ ਮੈਂ ਸ਼ੁਰੂ ਕਰਾਂਗਾ ਆਪਣਾ ਟੂਰ ਅਤੇ ਮਿਲਦੇ ਹਾਂ ਫਿਰ ਓਕੇ ਫਿਰ ਬਾਏ ਓਕੇ ਬਾਏ